ਸਵੈ ਬੁਣਾਈ ਕਰਨ ਦੌਰਾਨ ਮੈਨੂੰ ਸਭ ਤੋਂ ਮੈਨੂੰ ਮੈਨੂੰ ਸਵੈਟਰ ਟੋਪੀਆਂ ਜਾਂ ਹੋਰ ਕਿਸਮ ਦੇ ਕੱਪੜੇ ਬਣੌਨ ਵਿੱਚ ਸਭ ਤੋਂ ਵੱਧ ਰੁਚੀ ਸਵੈਟਰ ਬਣਾਣ ਵਿੱਚ ਸੀ ਜਿਹੜੀ ਮੈਂ ਲੋਕਾਂ ਬੜੇ ਸਵੈਟਰ ਬਣਾਏ ਆਪਣੇ ਭਾ ਪਿਤਾ ਜੀ ਦਾ ਬਣਾਇਆ ਫਿਰ ਉਨ੍ਹਾਂ ਨੂੰ ਵੇਖ ਵੇਖ ਕੇ ਹੋਰ ਲੋਕਾਂ ਨੇ ਵੀ ਦੇਖਿਆ ਤੇ ਅਸੀਂ ਹੋਰ ਲੋਕਾਂ ਦੇ ਵੀ ਸਵੈਟਰ ਬਣਾਨ ਲੱਗ ਗੇ ਤੇ ਏਸ ਤਰ੍ਹਾਂ ਹੌਲੀ ਹੌਲੀ ਕਰਦੇ ਕਰਦੇ ਸਾਡਾ ਨਾ ਸਵੈਟਰ ਬਣਾਨ ਦਾ ਬਿਜਨਸ ਹੀ ਹੋ ਗਿਆ ਆਸੇ ਪਾਸੇ ਦੇ ਲੋਕੀਂ ਸਾਰੇ ਕਹਿਣ ਲੱਗਗੇ ਕੀ ਸਵੈਟਰ ਬਹੁਤ ਸੋਹਣਾ ਤੁਸੀਂ ਨਾ ਸਾਡਾ ਵੀ ਸਵੈਟਰ ਬਣਾਓ ਏਸ ਤਰ੍ਹਾਂ ਬਣਾਂਦੇ ਬਣਾਂਦੇ ਅਸੀਂ ਕਾਫ਼ੀ ਸਵੈਟਰ ਬਣਾ ਲੇ ਤੇ ਮੈਨੂੰ ਇਹਨਾਂ ਵਿੱਚੋਂ ਸਭ ਤੋਂ ਜਿਆਦਾ ਸਵੈਟਰ ਬਣਾਨ ਦਾ ਈ ਸ਼ੌਂਕ ਵਿਸ਼ੇਸ਼ ਸ਼ੌਂਕ ਸੀ ਇਸ ਕਰਕੇ ਸਵੈਟਰ ਦਾ ਈ ਮੈਂ ਬਿਜ਼ਨਸ ਸ਼ੁਰੂ ਕਰ ਲਿਆ ਹੁਣ ਐਸ ਟੈਮ ਅਸੀਂ ਕਾਫ਼ੀ ਵਧੀਆ ਵਧੀਆ ਸਵੈਟਰ ਬਣਾਂਦੇ ਪਏ ਆਂ ਸਾਰੇ ਆਸੇ ਪਾਸੇ ਵਾਲੇ ਲੋਕੀਂ ਸਾਡੇ ਕੋ ਬਣਵਾਂਦੇ ਨੇ ਵੈਸੇ ਬਣਾਨ ਨੂੰ ਤੇ ਅਸੀਂ ਸ ਟੋਪੀਆਂ ਜਾਂ ਹੋਰ ਚੀਜਾਂ ਵੀ ਬਣਾ ਲੈਣੇ ਆਂ ਪਰ ਸਵੈਟਰ ਸਭ ਤੋਂ ਜਿਆਦਾ ਬਣਾਨੇ ਆਂ ਇਸ ਤਰ੍ਹਾਂ ਹੁਣ ਇਸ ਟਾਈਮ ਸਾਡਾ ਬਿਜ਼ਨਸ ਕਾਫ਼ੀ ਵਧੀਆ ਚੱਲ ਗਿਆ ਐ ਕਿਉਂ ਕਿਉਂਕੀ ਇਹ ਖਾਸ ਚੀਜ ਸਵੈਟਰ ਈ ਬਣਾਣਾ ਐ ਅਸੀਂ ਆਸੇ ਪਾਸੇ ਲੋਕਾਂ ਕੋਲੋਂ ਵੀ ਸਵੈਟਰ ਬਣਵਾ ਲੈਨੇ ਆਂ ਤੇ ਹੋਰ ਕਿਸਮ ਦੇ ਕੱਪੜਿਆਂ ਤੇ ਜਿਆਦਾ ਰੁਚੀ ਨੀ ਹੈਗੀ ਸਿਰਫ਼ ਸਵੈਟਰ ਤੇ ਈ ਆਂ ਸਵੈਟਰ ਅਸੀਂ ਸਾਡੇ ਭੈਣਾਂ ਭਰਾਵਾਂ ਸਭ ਘਰ ਦੇ ਬਣੇ ਸਵੈਟਰ ਪਾਨੇ ਆਂ ਬਜਾਰ ਦੇ ਸਵੈਟਰ ਬਹੁਤ ਘੱਟ ਈ ਪਾਨੇ ਆਂ ਇਸ ਤਰ੍ਹਾਂ ਇੱਕ ਬਹੁਤ ਵਧੀਆ ਚੀਜ਼ ਬਣ ਗਈ ਐ ਸਵੈਟਰ ਬਣਾਨਾ ਹੌਲੀ ਹੌਲੀ ਅਸੀਂ ਇਸ ਤੋਂ ਵੀ ਵੱਧ ਹੋਰ ਬਣਾਵਾਂਗੇ ਧੰਨਵਾਦ